ਹੈਲੋ ਹਾਂਜੀ ਹਾਂਜੀ ਮੈਂ ਆਪਣਾ ਹੈਗਾ ਆਪਣਾ ਸੀਨੀਅਰ ਸਿਟੀਜਨ ਆਪਣਾ ਗੌਰਮੈਂਟ ਸਟੇਟ ਗੌਰਮੈਂਟ ਇੰਪਲਾਈ ਤੋਂ ਰਿਟਾਇਰ ਹੋਇਆ ਅਤੇ ਸਾਡੇ ਬੱਚੇ ਨਾ ਆਪਣਾ ਉਹ ਬਾਹਰ ਜਾਣ ਦੀ ਬੜੀ ਜਿੱਦ ਕਰਦੇ ਆ ਅਤੇ ਉਹ ਅਸੀਂ ਸੋਚਦੇ ਇੱਥੇ ਬੱਚੇ ਰਹਿਣ ਸਾਡੇ ਕੋਲ ਰਹਿਣ ਸਗੋਂ ਅਤੇ

ਹਾਂ ਅਤੇ ਉਹ ਭਾਵੇਂ ਉੱਥੇ ਜਾ ਕੇ ਭਾਵੇਂ ਉਹ ਮਤਲਬ ਟਰੱਕ ਚਲਾਉਣ ਜਾਂ ਟਰੇਲਰ ਟਰਾਲਾ ਚਲਾਉਣ ਇਹੋ ਜਿਹੇ ਕੰਮ ਕਰਦੇ ਨੇ ਅਤੇ ਏ ਹਾਂ ਇੱਥੇ ਹਾਂ ਇੱਥੇ ਮਿਹਨਤ ਕਰਨ ਤਾਂ ਸਭ ਕੁਝ ਹੈਗਾ ਇੱਥੇ ਆਪਣਾ

ਹਾਂ ਹਾਂ ਪਰ ਬੱਚੇ ਸੋਚਦੇ ਨਹੀਂ ਨਾ ਹੈਗੇ ਉਹ ਬਾਹਰ ਦੀ ਬੜੀ ਕਰੇਜ਼ ਬਣਿਆ ਕਰੇਜ਼ ਬਣਿਆ ਬਾਹਰ ਜਾਣ ਦਾ ਹੀ ਅਤੇ ਬਾਹਰ ਹੀ ਜਾਣਾ ਹਾਂ ਕਈ ਭਾਵੇਂ ਡੋਂਕੀ ਡੋਂਕੀ ਲਗਾ ਕੇ ਜਾਂਦੇ ਨੇ ਕਈ ਕਈ ਕਈ ਰਾਹ 'ਚ ਹੀ ਫੜੇ ਜਾਂਦੇ ਨੇ ਕਈ ਆਪਣਾ ਉਹ ਜੰਗਲਾਂ ਜ ਜੰਗਲਾਂ ਥਾਣੀ ਜਾਂਦੇ ਨੇ ਉੱਥੇ ਕੋਈ ਹਾਂ ਆਈਲੈਟ ਉਸ ਤੋਂ ਬਾਅਦ ਆਈਲੈਟ ਕਰਕੇ ਨਾ ਆਈਲੈਟ ਕਰਕੇ ਫਿਰ ਉਹ ਬਾਹਰ ਜਾਣ ਦੀ ਬੜੀ ਜਿੱਦ ਕਰਦੇ ਆ ਕਿ ਬਾਹਰ ਚਲੀਏ ਅਤੇ ਬਾਹਰ ਹੀ ਜਾ ਕੇ ਹਮ ਚਲੋੋੋੋ ਠੀਕ ਹੈ ਠੀਕ ਹੈ ਜੀ